ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ

ਸਕੂਲ ਵਿੱਚ ਵਧੇਰੇ ਕਿੱਤਾ ਮੁਖੀ ਸਿੱਖਿਆ ਦੇਣੀ ਚਾਹੀਦੀ ਹੈ ਜਿਵੇਂ ਤਰਖਾਣ ਪਲੰਬਰਿੰਗ ਸਿਖਲਾਈ ਅਤੇ ਪੋਲਟਰੀ ਅਤੇ ਪਸ਼ੂ ਪਾਲਣ ਬਾਰੇ ਸਕੂਲ ਤੋਂ ਹੀ ਬੱਚਿਆਂ ਨੂੰ ਸਿੱਖਿਅਤ ਕਰਨਾ ਚਾਹੀਦਾ ਹੈ ਇਸ ਕਿੱਤਾ ਮੁਖੀ ਸਿੱਖਿਆ ਉਹਨਾਂ ਲਈ ਉਮਰ ਭਰ ਕੰਮ ਆਵੇਗੀ ਕਿੱਤਾ ਮੁਖੀ ਸਿੱਖਿਆ ਅੱਜ ਸਮੇਂ ਦੀ ਲੋੜ ਹੈ ਜੇਕਰ ਆਪਾਂ ਸਕੂਲਾਂ ਵਿੱਚ ਕਿੱਤਾ ਮੁਖੀ ਸਿੱਖਿਆ ਦੇਵਾਂਗੇ ਤਾਂ ਇਸ ਨਾਲ ਸਾਡੀ ਆਉਣ ਵਾਲੀ ਪੀੜੀ ਜਿਹੜੀ ਇੱਕ ਵਧੀਆ ਕਾਰੀਗਰ ਪੈਦਾ ਕਰੇਗੀ ਸਰਕਾਰ ਨੂੰ ਚਾਹੀਦਾ ਹੈ ਕਿ ਸਕੂਲਾਂ ਵਿੱਚ ਤੋਂ ਹੀ ਛੇਵੀਂ ਜਮਾਤ ਤੋਂ ਕਿੱਤਾ ਮੁਖੀ ਸਿੱਖਿਆ ਬੱਚਿਆਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਆਪਾਂ ਪਰਿਪੱਕ ਲੋਕ ਪਰਿਪੱਕ ਬੱਚੇ ਤਿਆਰ ਕਰੀਏ ਤਾਂ ਜੋ ਭਵਿੱਖ ਵਿੱਚ ਉਹ ਬੱਚੇ ਹੁਨਰ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਸੁਖ ਸੁਖਾਲਾ ਬਣਾ ਸਕਣ ਅਤੇ ਇੱਕ ਵਧੀਆ ਜ਼ਿੰਦਗੀ ਜੀ ਸਕਣ ਧੰਨਵਾਦ